ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਪ੍ਰੀਤੀ ਮਾਨਸੇ ਤੋਂ ਓਕੇ ਪਹਿਚਾਣ ਲਿਆ ਪਹਿਚਾਣ ਲਿਆ ਹੋਰ ਹੋਰ ਪ੍ਰਿਯੰਕਾ ਕੀ ਹਾਲ ਹੈ ਤੇਰਾ ਮੈਨੂੰ ਨਾਮ ਯਾਦ ਹੈ ਤੇਰਾ ਓਕੇ ਹੋਰ ਪ੍ਰੀਤੀ ਕਿੱਦਾਂ ਠੀਕ ਹੈ ਬਸ ਵਧੀਆ ਵਧੀਆ ਅੱਜ ਕਿਵੇਂ ਯਾਦ ਕੀਤਾ ਓਕੇ ਬਲਰਾਜ ਬਾਬਾ ਬਲਰਾਜ ਕੋਲੇਜ 'ਚ ਓਕੇ ਹਾਂਜੀ ਅੱਛਾ ਤੁਸੀਂ ਹੋਸਟਲ ਜੋਆਇਨ ਕਰਨਾ ਇੱਥੇ ਆ ਕੇ ਹੈ ਨਾ ਵੈਦਰ ਅੱਜ ਕੱਲ੍ਹ ਠੀਕ ਠੀਕ ਚੱਲ ਰਿਹਾ ਠੰਡ ਵੀ ਹੈ ਮਤਲਬ ਸਵੇਰੇ ਸ਼ਾਮ ਕਾਫੀ ਠੰਡ ਹੈ ਅਤੇ ਦੁਪਹਿਰ ਨੂੰ ਮੀਨਜ਼ ਉਹ ਠੀਕ ਹੀ ਹੁੰਦਾ ਹੈ ਜਿੱਦਾਂ ਤੋ ਤੁਸੀਂ ਆਪਣੇ ਹਜੇ ਤਾਂ ਫਿਲਹਾਲ ਤਾਂ ਨੋਰਮਲ ਜਿਹੇ ਹੀ ਕੱਪੜੇ ਲੈ ਕੇ ਆਇਓ ਜੇ ਲਿਆਣੇ ਆਪਣੇ ਅਤੇ ਪਰ ਇਹ ਵੀ ਦਸੰਬਰ 'ਚ ਕਾਫੀ ਠੰਡ ਹੋ ਜਾਣੀ ਹੈ ਐਕਸਟ੍ਰੀਮਲੀ ਠੰਡ ਹੋ ਜਾਂਦੀ ਕਿਉਂਕਿ ਸਾਡਾ ਜਿਹੜਾ ਸ਼ਹਿਰ ਹੈ ਪਹਾੜਾਂ ਦੇ ਪੈਰਾਂ 'ਚ ਹੈ ਜਿਵੇਂ ਹੈ ਨਾ ਤੋ ਤੁਹਾਡੀ ਸਿਸਟਰ ਨੂੰ ਪਤਾ ਹੀ ਹੈ ਸੋ ਉਦੋਂ ਬਹੁਤ ਠੰਡ ਹੁੰਦੀ ਧੁੰਦਾਂ ਕਾਫੀ ਪੈਂਦੀਆਂ ਉਦੋਂ ਤੁਹਾਨੂੰ ਥੋੜ੍ਹੇ ਮੋਟੇ ਕੱਪੜਿਆਂ ਦੀ ਜ਼ਰੂਰਤ ਪੈਣੀ ਹੈ ਹੈ ਨਾ ਸੋ ਉਸ ਹਿਸਾਬ ਨਾਲ ਹੀ ਤੁਸੀਂ ਆਪਣੇ ਕੱਪੜੇ ਲੈ ਕੇ ਆਇਓ ਅਤੇ ਬਾਕੀ ਦੇਖ ਲਿਓ ਤੁਸੀਂ ਕੋਈ ਗੱਲ ਨਹੀਂ ਤੁਸੀਂ ਆਉਣਾ ਕਦੋਂ ਇੱਥੇ ਤਿੰਨ ਚਾਰ ਦਿਨ ਤੱਕ ਆ ਜਾਣਾ ਹੈ ਅਤੇ ਪਹਿਲਾਂ ਫਿਰ ਘਰ ਆ ਜਿਓ ਤੁਸੀਂ ਹੋਸਟਲ ਜ਼ਰੂਰੀ ਰਹਿਣਾ ਵਾ ਇੱਥੇ ਹੀ ਰਿਹੋ ਸਾਡੇ ਕੋਲ ਘਰ ਹੀ ਓਕੇ ਓਕੇ ਓਕੇ ਬਸ ਤੁਸੀਂ ਇਹੋ ਜਿਹੇ ਕੱਪੜੇ ਚੱਕ ਲੋ ਹੁਣ ਤੁਸੀਂ ਦੇਖ ਲੋ ਜੇ ਤਾਂ ਤੁਸੀਂ ਮੀਨ ਮਤਲਬ ਤੁਹਾਡਾ ਮੁੜ ਕੇ ਛੇਤੀ ਟੂਰ ਲੱਗਣਾ ਆ ਤਾਂ ਤੁਸੀਂ ਫਿਰ ਆਪਣੇ ਜ਼ਿਆਦਾ ਗਰਮ ਕੱਪੜੇ ਚੱਕ ਲਿਓ ਜੇ ਤੁਸੀਂ ਮੁੜ ਕੇ ਨਹੀਂ ਜਾਣਾ ਹੁਣ ਮਤਲਬ ਦੋ ਚਾਰ ਮਹੀਨੇ ਬਾਅਦ ਹੀ ਵਾਪਸ ਜਾਣਾ ਘਰ ਤਾਂ ਤੁਸੀਂ ਆਪਣੇ ਤੁਹਾਨੂੰ ਸਾਰੇ ਹੀ ਕੱਪੜੇ ਚੱਕ ਕੇ ਲਿਆਣੇ ਪੈਣੇ ਆ ਕੁਛ ਨੋਰਮਲ ਵੀ ਤਾਂ ਕੁਛ ਥੋੜ੍ਹੇ ਹੈਵੀ ਵੀ ਹੈ ਨਾ ਹੋਰ ਬਾਕੀ ਪ੍ਰਿਯੰਕਾ ਇੰਨਾ ਬੋਦਰ ਵੀ ਨਾ ਕਰੀਂ ਅਸੀਂ ਇੱਥੇ ਹੈਗੇ ਹਾਂ ਮੈਂ ਇੱਥੇ ਹਾਂ ਲੋਕਲ ਬੈਠੀ ਹਾਂ ਅਤੇ ਜਿਵੇਂ ਤੈਨੂੰ ਲੋੜ ਪਈ ਆਈ ਥਿੰਕ ਮੈਂ ਤੈਨੂੰ ਦੇਖਿਆ ਹੋਇਆ ਵੀ ਮ ਮੇ ਮੇਰੇ ਕੱਪੜੇ ਗਰਮ ਤੈਨੂੰ ਆ ਜਾਣੇ ਹੈ ਹੈ ਨਾ ਜੇ ਲੋੜ ਪਈ ਤਾਂ ਮੇਰੇ ਕੋਲੋਂ ਲੈ ਲਈ ਹੈ ਨਾ ਮੈਂ ਰਜਾਈ ਵਗੈਰਾ ਚੁੱਕਣ ਦੀ ਲੋੜ ਨਹੀਂ ਤੈਨੂੰ ਉਹ ਤੂੰ ਇੱਥੋਂ ਹੀ ਲੈ ਲਈ ਕਿਉਂਕਿ ਬਹੁਤ ਤੇਰਾ ਹੈਵੀ ਹੋ ਜਾਏਗਾ ਸਾਰਾ ਸਟੱਫ ਉਹ ਇੱਥੋਂ ਹੀ ਮੇਰੇ ਕੋਲੇ ਲੈ ਲਈ ਤੂੰ ਹੈ ਨਾ ਠੀਕ ਹੈ ਓਕੇ ਵੈੱਲਕਮ ਵੈੱਲਕਮ